ਹਾਂ ਹੈਲੋ ਓਲਾ ਵਾਲੇ ਬੋਲਦੇ ਆ ਹਾਂ ਉਹ ਟੈਕਸੀ ਬੁੱਕ ਕਰਵਾਈ ਸੀਗੀ ਤੁਹਾਡਾ ਡਰਾਈਵਰ ਜਿਹੜਾ ਪ੍ਰਤਾਪ ਸਿੰਘ ਉਹ ਮਤਲਬ ਪਤਾ ਨਹੀਂ ਲੱਗ ਰਿਹਾ ਕਿੱਥੇ ਆ ਰਿਹਾ ਪਿੱਕ ਪੁਆਇੰਟ 'ਤੇ ਉਹ ਪਤਾ ਨਹੀਂ ਮਤਲਬ ਦੇਖਿਆ ਤਾਂ ਹੈ ਨਹੀਂ ਮੈਂ ਹਾਂ ਤੁਸੀਂ ਇੱਦਾਂ ਕਰੋ ਉਹਨੂੰ ਫੋਨ ਕਰੋ ਅਤੇ ਉਹ ਲੋਕੇਸ਼ਨ ਜਿਹੜੀ ਹੈ ਨਾ ਉਹ ਗੁੱਚੀ ਹੋਸਪੀਟਲ ਦੇ ਲਾਗੇ ਕਿਧਰੇ ਉੱਥੇ ਨੇੜੇ ਚਾਰ ਸੌ ਪੰਜ ਨੰਬਰ ਦੇ ਵਿੱਚ ਉੱਥੇ ਭੇਜ ਦਿਉ ਆਪਦਾ ਬਹੁਤ ਬਹੁਤ ਧੰਨਵਾਦ ਇਹ ਮੇਰੀ ਪਲੀਜ਼ ਹੈਲਪ ਕਰ ਦਿਉ